ਹੈਲੋ ਹਾਂਜੀ ਭਾਅ ਜੀ ਮੈਂ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਜਗਦੀਸ਼ ਕੁਮਾਰੀ ਮੈਂ ਤੁਹਾਡੇ ਕੋਲ ਕੱਲ੍ਹ ਕੈਬ ਬੁੱਕ ਕਰਵਾਈ ਸੀ ਅਤੇ ਤੁਸੀਂ ਟਾਈਮ ਨਾਲ ਨਹੀਂ ਆਏ ਮੈਂ ਤੁਹਾਡੀ ਵੇਟ ਕਰਦੀ ਪਈ ਹਾਂ ਮੈਂ ਕਦੋਂ ਦੀ ਤੁਹਾਡੀ ਵੇਟ ਕਰ ਰਹੀ ਦੋਂ ਤੁਸੀਂ ਪਹੁੰਚੇ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕੱਲ੍ਹ ਹੀ ਕਿਹਾ ਸੀ ਕਿ ਮੈਨੂੰ ਜ਼ਰੂਰੀ ਜਾਣਾ ਹੈ ਮੈਂ ਉੱਥੇ ਕੱਲ੍ਹ ਤੁਸੀਂ ਮੈਨੂੰ ਕਿਹਾ ਸੀ ਕਿ ਹਾਂਜੀ ਠੀਕ ਹੈ ਮੈਂ ਤੁਹਾਨੂੰ ਸੱਤ ਵਜੇ ਦਾ ਟਾਈਮ ਦਿੱਤਾ ਸਵੇਰੇ ਮੈਂ ਸੱਤ ਵਜੇ ਤੱਕ ਪਹੁੰਚ ਜਾਵਾਂਗਾ ਉੱਥੇ ਤੁਸੀਂ ਹਜੇ ਤੱਕ ਨਹੀਂ ਪਹੁੰਚੇ ਇਸ ਤਰ੍ਹਾਂ ਤਾਂ ਗੱਲ ਨਹੀਂ ਬਣਦੀ ਭਾਅ ਜੀ ਫਿਰ ਮੈਂ ਤੁਹਾਡੀ ਵੇਟ ਕਰਦੀ ਰਹੀ ਹਾਂ ਅੱਠ ਵੱਜ ਗਏ ਆ ਤੁਸੀਂ ਹਜੇ ਤੱਕ ਪਹੁੰਚੇ ਨਹੀਂ ਹੈਗੇ ਉੱਥੇ ਮੈਨੂੰ ਜ਼ਰੂਰੀ ਕੰਮ ਸੀ ਉੱਥੇ ਇਸ ਕਰਕੇ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਆਉਣਾ ਵਾ ਤੁਸੀਂ ਤੱਕ ਪਹੁੰਚੇ ਨਹੀਂ ਉੱਥੇ ਮੇਰਾ ਉੱਥੇ ਪਰਸਨਲ ਕੰਮ ਸੀ ਕੰਮ ਵੀ ਮੇਰਾ ਭੱਜ ਗਿਆ ਅੱਠ ਵਜੇ ਦੀ ਵੇਟ ਕਰਦੀ ਪਈ ਹਾਂ ਮੈਂ ਤੁਹਾਡੀ ਤੁਸੀਂ ਮੈਨੂੰ ਟਾਈਮ ਵੀ ਦਿੱਤਾ ਸੀ ਕਿ ਮੈਂ ਸੱਤ ਵਜੇ ਪਹੁੰਚਾਗਾ ਤੁਸੀਂ ਹਜੇ ਤੱਕ ਪਹੁੰਚੇ ਨਹੀਂ ਮੇਰਾ ਕੰਮ ਉੱਥੇ ਸਾਰਾ ਭੱਜ ਗਿਆ ਇਸ ਕਰਕੇ ਮੈਂ ਤੁਹਾਡੀ ਜਿਹੜੀ ਕੈਬ ਬੁੱਕ ਕਰਵਾਈ ਸੀ ਮੈਂ ਉਹ ਕੈਂਸਲ ਕਰਦੀ ਪਈ ਹਾਂ ਮੈਨੂੰ ਹੁਣ ਜ਼ਰੂਰਤ ਨਹੀਂ ਹੈਗੀ ਤੁਹਾਡੀ ਇਸ ਕਰਕੇ ਕੋਈ ਗੱਲ ਨਹੀਂ ਮੈਂ ਆਪਣੇ ਹਸਬੈਂਡ ਨਾਲ ਚੱਲ ਜਾਂਗੀ ਇਸ ਕਰਕੇ ਤੁਹਾਨੂੰ ਖੇਚਲ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਹੋਰ ਕੰਮ ਦੇਖੋ ਜਿਹੜਾ ਤੁਹਾਡਾ ਜ਼ਰੂਰੀ ਆ ਤੁਸੀਂ ਮੈਨੂੰ ਪਹਿਲਾਂ ਹੀ ਫੋਨ ਕਰਕੇ ਕਿਹਾ ਸੀ ਕਿ ਮੈਂ ਤੁਹਾਡੇ ਪਹੁੰਚ ਜਾਵਾਂਗਾ ਇਸ ਕਰਕੇ ਮੈਂ ਮੈਨੂੰ ਜ਼ਰੂਰਤ ਨਹੀਂ ਠੀਕ ਹੈ ਓਕੇ ਠੀਕ ਹੈ ਭਾਅ ਜੀ ਬਾਏ